ਅੱਜ ਮੈਂ ਤੁਹਾਡੇ ਸਾਰਿਆਂ ਸਾਹਮਣੇ ਆਪਣਾ ਇੱਕ ਤਜ਼ਰਬਾ ਸਾਂਝਾ ਕਰਨ ਜਾ ਰਿਹਾ ਹਾਂ ਜੋ ਕਿ ਬਹੁਤ ਵਧੀਆ ਰਿਹਾ ਕਿਉਂਕਿ ਮੈਨੂੰ ਆਪਣੇ ਕੰਮ ਕਾਜ ਲਈ ਅਤੇ ਦਫਤਰੀ ਕੰਮ ਕਾਜ ਲਈ ਅਤੇ ਬੱਚਿਆਂ ਦੀ ਪੜ੍ਹਾਈ ਵਾਸਤੇ ਇੱਕ ਅਜਿਹੇ ਯੰਤਰ ਦੀ ਲੋੜ ਸੀ ਜੋ ਕਿ ਮੇਰੀਆਂ ਅਤੇ ਮੇਰੇ ਪਰਿਵਾਰ ਦੀਆਂ ਜ਼ਰੂਰਤਾਂ ਨੂੰ ਪੂਰੀਆਂ ਕਰਦਾ ਹੋਵੇ ਇਸ ਲਈ ਮੈਂ ਆਪਣੇ ਯਾਰਾਂ ਦੋਸਤਾਂ ਨਾਲ ਮਿਲ ਕੇ ਲੈਪਟੋਪ ਖਰੀਦਣ ਬਾਰੇ ਸੋਚਿਆ ਸਭ ਤੋਂ ਪਹਿਲਾਂ ਮੈਂ ਗੂਗਲ 'ਤੇ ਜਾ ਕੇ ਇਸਦੀ ਭਾਲ ਸ਼ੁਰੂ ਕੀਤੀ ਜੋ ਕਿ ਮੇਰੇ ਵਾਸਤੇ ਬਹੁਤ ਹੀ ਵਧੀਆ ਸਾਬਤ ਹੋਈ ਕਿਉਂਕਿ ਗੂਗਲ ਤੋਂ ਮੈਨੂੰ ਇਸ ਦੀ ਕਿਸਮ ਅਸ ਕਿਸਮ ਅਤੇ ਵਿਸ਼ੇਸ਼ਤਾ ਬਾਰੇ ਪਤਾ ਲੱਗਿਆ ਜੋ ਮੇਰੀਆਂ ਜਰੂਰਤਾਂ ਪੂਰੀਆਂ ਕਰ ਰਿਹਾ ਸੀ ਫਿਰ ਮੈਂ ਐੱਚ ਪੀ ਦਾ ਲੈਪਟੋਪ ਲੈਣ ਲਈ ਆਪਣਾ ਮਨ ਬਣਾਇਆ ਮੈਂ ਇਸ ਨੂੰ ਖਰੀਦਣ ਲਈ ਇੱਕ ਵੈਬਸਾਈਟ 'ਤੇ ਭਾਲ ਕੀਤੀ ਮੈਨੂੰ ਇਸ ਦੀ ਕੀਮਤ ਜਾਇਜ਼ ਲੱਗੀ ਅਤੇ ਮੈਂ ਇਹ ਔਨਲਾਈਨ ਔਡਰ ਬੁੱਕ ਕੀਤਾ ਖਾਸ ਤਜ਼ਰਬਾ ਇਹ ਹੋਇਆ ਕਿ ਮੈਨੂੰ ਘਰ ਬੈਠੇ ਨੂੰ ਇਹ ਪ੍ਰਾਪਤ ਹੋਇਆ ਮੈਂ ਪੈਸੇ ਵੀ ਲੈਪਟੋਪ ਪ੍ਰਾਪਤ ਕਰਨ ਤੋਂ ਬਾਅਦ ਕੰਪਨੀ ਸਟਾਫ ਨੂੰ ਦਿੱਤੇ ਇਸ ਵਿੱਚ ਮੈਨੂੰ ਦੋ ਸਾਲਾਂ ਦੀ ਕੰਪਨੀ ਵੱਲੋਂ ਗਰੰਟੀ ਵੀ ਦਿੱਤੀ ਗਈ ਸੋ ਮੈਂ ਸਭ ਨੂੰ ਇਹੀ ਕਹਿਣਾ ਚਾਹੁੰਦਾ ਕਿ ਮੇਰਾ ਔਨਲਾਈਨ ਖਰੀਦਣ ਦਾ ਜੋ ਤਜ਼ਰਬਾ ਸੀ ਉਹ ਬਹੁਤ ਵਧੀਆ ਰਿਹਾ ਧੰਨਵਾਦ